ਪਾਲਤੂ ਅਤੇ ਬੇਜਵਾਨ ਜਾਨਵਰਾਂ ਅਤੇ ਪੰਛੀਆਂ ਨੂੰ ਪਿਆਰ ਪਾਉਣਾ ਇੱਕ ਬਹੁਤ ਹੀ ਵੱਡੀ ਗੱਲ ਹੈ ਜੋ ਕਿ ਕੁਦਰਤ ਦਾ ਰੂਲ ਹੈ ਨਾ ਉਹ ਕਿਸੇ ਤੋਂ ਮੰਗ ਕੇ ਖਾ ਸਕਦੇ ਆ ਨਾ ਹੀ ਬੋਲ ਕੇ ਖਾ ਸਕਦੇ ਆ ਉਹਨਾਂ ਕੋਲ ਕੋਈ ਸਾਧਨ ਨਹੀਂ ਮੈਂ ਜਿਵੇਂ ਕਿ ਪਿੰਡ ਵਿੱਚ ਰਹਿੰਦਾ ਹੈ ਮੇਰੇ ਘਰ ਦੇ ਬਾਹਰ ਇੱਕ ਕੁੱਤੀ ਸੂਈ ਉਸਨੇ ਤਿੰਨ ਬੱਚੇ ਦਿੱਤੇ ਪਹਿਲੇ ਦਿਨ ਤੋਂ ਹੀ ਮੈਂ ਉਹਨਾਂ ਨੂੰ ਪਹਿਲਾਂ ਰੋਟੀ ਪਾਈ ਫਿਰ ਮੈਂ ਉਹਨਾਂ ਨੂੰ ਦੁੱਧ ਪਾਉਣ ਲੱਗ ਗਿਆ ਰ ਹੁਣ ਮੇਰੀ ਇਸ ਟਾਈਮ ਰੋਜ਼ਾਨਾ ਦੀ ਰੂਟੀਨ ਹੈ ਕਿ ਮੈਂ ਉਹਨਾਂ ਨੂੰ ਦੋ ਟਾਈਮ ਦੁੱਧ ਅਤੇ ਰੋਟੀ ਪਾਉਂਦਾ ਹਾਂ ਉਹ ਮੇਰੇ ਇੰਨੇ ਕੁ ਵਫਾਦਾਰ ਬਣ ਚੁੱਕੇ ਹਨ ਕਿ ਮੇਰੇ ਘਰ ਦੇ ਬਾਹਰ ਕੋਈ ਵੀ ਬੇਗਾਨਾ ਬੰਦਾ ਬੇਗਾਨਾ ਕੋਈ ਜਾਨਵਰ ਜਾਂ ਪੰਛੀ ਕਿਸੇ ਨੂੰ ਵੀ ਨਹੀਂ ਰਹਿਣ ਦਿੰਦੇ ਜਾਨਵਰਾਂ ਦੇ ਵਿੱਚ ਜੇ ਆਪਾਂ ਉਹਨਾਂ ਦੇ ਪਿਆਰ ਤਾਂ ਦੇਖੀਏ ਜੇ ਆਪਾਂ ਉਹਨਾਂ ਨੂੰ ਪਿਆਰ ਕਰਾਂਗੇ ਤਾਂ ਆਪਾਂ ਨੂੰ ਪਿਆਰ ਕਰਨਗੇ ਜੇ ਆਪਾਂ ਉਹਨਾਂ ਨੂੰ ਝਿੜਕਣ ਲੱਗ ਗਏ ਜਾਂ ਉਹਨਾਂ ਨੂੰ ਮਾਰਨ ਲੱਗ ਗਏ ਤਾਂ ਉਹ ਆਪਾਂ ਨੂੰ ਮਾਰਨ ਜਾਂ ਵੱਢਣ ਲੱਗ ਜਾਣਗੇ ਮੇਰਾ ਮੰਨਣਾ ਇਹ ਹੈ ਕਿ ਜਿਹੜੇ ਪਾਲਤੂ ਜਾਨਵਰ ਨੇ ਪਾਲਤੂ ਜਾਨਵਰ ਜਿਵੇਂ ਕਿ ਕੁੱਤਾ ਹੈ ਕੁੱਤੇ ਨੂੰ ਅਸੀਂ ਪਾਲਦੇ ਹਾਂ ਉਹ ਬਹੁਤ ਹੀ ਵਧੀਆ ਤੁਹਾਡੀ ਤੁਹਾਡੇ ਨਾਲ ਇੱਕ ਪਰਿਵਾਰਕ ਮੈਂਬਰ ਵਾਂਗ ਤੁਹਾਡਾ ਰਿਸ਼ਤਾ ਬਣ ਜਾਏਗਾ ਜੋ ਕਿ ਬਹੁਤ ਹੀ ਵਧੀਆ ਹੈ ਜੋ ਤੁਹਾਡੀ ਵਫਾਦਾਰੀ ਅਤੇ ਤੁਹਾਡੀ ਸੇਫਟੀ ਲਈ ਜ਼ਰੂਰੀ ਹੈ ਮੇਰੇ ਹਿਸਾਬ ਦੇ ਨਾਲ ਬੰਦੇ ਨੂੰ ਜਾਨਵਰਾਂ ਜਾਂ ਕੁੱਤਿਆਂ ਦੇ ਨਾਲ ਪਿਆਰ ਪਾਉਣਾ ਬਹੁਤ ਹੀ ਜ਼ਰੂਰੀ ਹੈ